ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੰਪਨੀ ਤੋਂ ਇੱਕ ਔਡਰ ਮੰਗਾਇਆ ਸੀ ਅਤੇ ਔਡਰ ਮੇਰੇ ਕੋਲ ਹਫ਼ਤੇ ਦੇ ਵਿੱਚ ਵਿੱਚ ਪਹੁੰਚ ਗਿਆ ਪ੍ਰੰਤੂ ਜਦੋਂ ਮੈਂ ਉਹਦੀ ਪੈਕਜਿੰਗ ਦੇਖੀ ਤਾਂ ਪੈਕਜਿੰਗ ਬਹੁਤ ਖ਼ਰਾਬ ਸੀ ਅਤੇ ਮੈਂ ਬਹੁਤ ਚਿੰਤਾ ਵਿੱਚ ਪੈ ਗਿਆ ਅਤੇ ਜਦੋਂ ਉਸ ਪ੍ਰੋਡਕਟ ਨੂੰ ਖੋਲ੍ਹਕੇ ਦੇਖਿਆ ਤਾਂ ਦੇਖਿਆ ਕਿ ਪੈਕਜਿੰਗ ਖ਼ਰਾਬ ਹੋਣ ਦੇ ਨਾਲ ਨਾਲ ਉਸ ਵਿੱਚ ਥੋੜ੍ਹੀ ਖ਼ਰਾਬੀ ਆ ਗਈ ਸੀ ਅਤੇ ਮੈਂ ਚਾਹੁੰਦਾ ਹਾਂ ਕਿ ਅੱਗੇ ਤੋਂ ਤੁਸੀਂ ਇਸ ਗੱਲ ਦਾ ਧਿਆਨ ਰੱਖੋ ਕਿਉਂਕਿ ਪਹਿਲਾਂ ਵੀ ਤੁਹਾਡੇ ਤੋਂ ਮੈਂ ਇਹ ਚੀਜ਼ਾਂ ਮੰਗਾਉਂਦਾ ਰਹਿੰਦਾ ਹਾਂ ਪਰ ਪੈਕਜਿੰਗ ਦੀ ਕੋਈ ਇਵੇਂ ਦੀ ਸਮੱਸਿਆ ਨਹੀਂ ਆਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਅੱਗੇ ਤੋਂ ਮੇਰੀ ਗੱਲ 'ਤੇ ਗੌਰ ਕਰੋਂਗੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਆਪਣੀ ਪੈਕਜਿੰਗ ਨੂੰ ਸੁਧਾਰ ਲਵੋ ਅਤੇ ਜਿਹੜੇ ਮੇਰੇ ਪ੍ਰੋਡਕਟ ਦੇ ਵਿੱਚ ਪੈਕਜਿੰਗ ਦੇ ਦੌਰਾਨ ਸਮੱਸਿਆ ਆਈ ਸੀਗੀ ਉਸਦੇ ਕਾਰਨ ਮੈਂ ਉਹ ਪ੍ਰੋਡਕਟ ਵੀ ਵਾਪਸ ਕਰਨਾ ਚਾਹੁੰਦਾ ਹਾਂ ਇਸ ਲਈ ਤੁਹਾਨੂੰ ਕਹਿੰਦਾ ਹਾਂ ਕਿ ਮੇਰਾ ਪ੍ਰੋਡਕਟ ਵਾਪਸ ਲੈ ਲਿਆ ਜਾਵੇ ਅਤੇ ਮੈਨੂੰ ਦੁਬਾਰਾ ਨਵਾਂ ਪ੍ਰੋਡਕਟ ਦੇ ਦਿੱਤਾ ਜਾਵੇ ਉਹ ਵੀ ਵਧੀਆ ਪੈਕਜਿੰਗ ਦੇ ਵਿੱਚ ਅਤੇ ਜਾਂ ਫਿਰ ਮੇਰੀ ਰੀਫੰਡ ਕਰ ਦਿੱਤੀ ਜਾਵੇ ਧੰਨਵਾਦ